ਭੰਗੜਾ ਕਰਨ ਨਾਲ ਸਰੀਰ ਦੇ ਸਾਰੇ ਅੰਗਾਂ ਦੀ ਐਕਸਰਸਾਈਜ਼ ਹੁੰਦੀ ਹੈ ਅਤੇ ਐਰੋਬਿਕਸ ਫਿਟਨੈਸ ਦੀ ਤਰ੍ਹਾਂ ਇਸ ਵਿੱਚ ਵੀ ਸਾਰੇ ਸਰੀਰ ਨੂੰ ਇੱਕ ਐਕਸਰਸਾਈਜ਼ ਕਰਨ ਦਾ ਤਰੀਕਾ ਮਿਲਦਾ ਹੈ ਭੰਗੜਾ ਇੱਕ ਖੁਸ਼ੀ ਦਾ ਪ੍ਰਤੀਕ ਹੈ ਅਤੇ ਭੰਗੜੇ ਵਿੱਚ ਉੱਚੀਆਂ ਹੇਕਾਂ ਲਗਾਉਣ ਦੇ ਨਾਲ ਸਾਨੂੰ ਹੋਰ ਵੀ ਖੁਸ਼ੀ ਦਾ ਪ੍ਰਗਟਾਵਾ ਕਰਨ ਦਾ ਮੌਕਾ ਮਿਲਦਾ ਹੈ ਭੰਗੜੇ ਮੁਤਾਬਿਕ ਅਸੀਂ ਆਪਣੇ ਸਰੀਰ ਨੂੰ ਫਿੱਟ ਵੀ ਰੱਖ ਸਕਦੇ ਹਾਂ ਅਤੇ ਆਪਣੇ ਦਿਮਾਗ ਨੂੰ ਵੀ ਸ਼ਾਂਤ ਰੱਖ ਸਕਦੇ ਹਾਂ ਕਿਉਂਕਿ ਭੰਗੜੇ ਦੇ ਨਾਲ ਸਰੀਰ ਦੇ ਨਾਲ ਨਾਲ ਆਪਣੇ ਦਿਮਾਗ ਆਪਣੇ ਮਨ ਨੂੰ ਵੀ ਆਪਾਂ ਖੁਸ਼ ਰੱਖਦੇ ਹਾਂ ਔਰ ਖੁਸ਼ ਰਹਿਣ ਦੇ ਨਾਲ ਸਾਨੂੰ ਸਰੀਰ ਦੇ ਵਿੱਚ ਫਿਟਨੈਸ ਆਉਂਦੀ ਹੈ ਅਤੇ ਸਾਡੇ ਵਿੱਚ ਪੋਜੀਟਿਵਨੈਸ ਆਉਂਦੀ ਹੈ ਇਸ ਤਰ੍ਹਾਂ ਨਾਲ ਭੰਗੜਾ ਆਰੋਬਿਕਸ ਫਿਟਨੈਸ ਦੀ ਤਨ ਦੁਨੀਆਂ ਵਿੱਚ ਸ਼ਮੂਲੀਅਤ ਅਤੇ ਵਿਭਿੰਨਤਾ ਦੇ ਕਾਰਨ ਇਹਨੂੰ ਸ਼ਾਮਿਲ ਕਰਨਾ ਚਾਹੀਦਾ ਹੈ ਕਿਉਂਕਿ ਭੰਗੜਾ ਸਾਰਿਆਂ ਨੂੰ ਉਤਸਾਹਿਤ ਕਰਦਾ ਹੈ ਜਿੱਥੇ ਵੀ ਆਪਾਂ ਭੰਗੜਾ ਦੇਖਦੇ ਹਾਂ ਉੱਥੇ ਲੋਕ ਖੁਸ਼ੀ ਖੁਸ਼ੀ ਇਸ ਨੂੰ ਮਹਿਸੂਸ ਕਰਦੇ ਨੇ ਅਤੇ ਦੇਖਦੇ ਹਨ ਔਰ ਇਸ ਨੂੰ ਭੰਗੜੇ ਨੂੰ ਕਰਨਾ ਵੀ ਚਾਹੁੰਦੇ ਹਨ ਕਿਉਂਕਿ ਭੰਗੜਾ ਦੁਨੀਆਂ ਦੇ ਵਿੱਚ ਇੱਕ ਬਹੁਤ ਵਧੀਆ ਡਾਂਸ ਮੰਨਿਆ ਜਾਂਦਾ ਹੈ